ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹੁੰਦਾ ਜੀ

ਉਹ ਤਾਂ ਦੇਖੋ ਦੇਖ ਦੇਖੋ ਮੇਰੇ ਕੋ ਲੱਕੜ ਹੈ ਜੀ ਜਿਹੜੇ ਕਿਸੇ ਦਾ ਬਣਾਉਣਾ ਹੈਗਾ ਉਹ ਹੀ ਦਾ ਬਣਵਾ ਦਿੰਦੇ ਹਾਂ ਜਿਵੇਂ ਹਾਂ ਜਿਹਾ ਜਾ ਤੁਸੀਂ ਵੀ ਲੱਕੜ ਕਿਹੋ ਜਿਹੀ ਪਾਉਣੀ ਆ

ਅੱਛਾ ਜੀ ਅੱਛਾ ਅੱਛਾ ਜੀ ਸਾਗਵਾਨ ਹੈ ਜੀ ਆਪਣੇ ਕੋਲ ਹੁੰਦੀ ਵਧੀਆ ਲੱਕੜ ਹਾਂ ਟਾਹਲੀ ਦੀ ਵੀ ਲੱਕੜ ਹੁੰਦੀ ਹੈ

ਟਾਹਲੀ ਦਾ ਜੀ ਟਾਹਲੀ ਜੇ ਸਾਰਾ ਕੁਝ ਬਣਾਓਗੇ ਜੀ ਆਪਣਾ ਵੀ ਲੱਗਦਾ ਉਹਦਾ ਵੀ ਬੈਡ ਵਗੈਰਾ 'ਤੇ ਸਾਰੇ ਕੁਝ ਅਤੇ ਉਹਦਾ ਆ ਜਾਂਦਾ ਆਪਣਾ ਤੀਹ ਹਜ਼ਾਰ ਰੁਪਈਆ ਪੈ ਜਾਂਦਾ ਜੀ ਉਹਦਾ

ਨਹੀਂ ਉਹ ਤਾਂ ਉਹੋ ਜਿਹਾ ਹੋ ਜੂਗਾ ਕੋਈ ਗੱਲ ਨਹੀਂ ਕਰ ਦਿਆਂਗੇ ਹਾਂ ਕਰਾਂਗੇ ਠੀਕ ਆ ਅਤੇ ਕਦੋਂ ਕੁ ਚਾਹੀਦਾ ਆਪਾ ਨੂੰ ਇਹ ਦਸ ਦਿਨਾਂ 'ਚ ਦਸ ਦਿਨ ਤਾਂ ਪੰਦਰਾ ਕੁ ਦਿਨ ਲੱਗ ਜਾਣਗੇ ਠੀਕ ਹੈ ਜੀ ਕੋਈ ਬਣਵਾ ਦਾਂਗੇ ਜਲਦੀ ਤਿਆਰ ਕਰਵਾ ਦਾਂਗੇ ਠੀ ਹਾਂ ਹਾਂ ਪੂਰੀ ਪੂਰੀ ਜੀ ਪੂਰੀ ਫੁੱਲ ਗਰੰਟੀ ਨਹੀਂ ਉਹ ਵੀ ਬਣਵਾਦਾਂਗੇ ਨਾ ਉਹ ਵੀ ਬਣਵਾਦਾਂਗੇ ਜੀ ਹਾਂਜੀ ਅੱਛਾ ਅੱਛਾ ਹਾਂ ਹਾਂ ਉਹ ਵੀ ਹੋਜੂਗਾ ਹੂੰ ਹੂੰ ਉਹ ਤਾਂ ਦੇਖੋ ਵੇਖ ਹਿਸਾਬ ਦਾ ਜਿਹਾ ਜਾ ਤੁਸੀਂ ਕਰਾਉਣਾ ਗਾ ਉਸ ਹਿਸਾਬ ਨਾਲ ਹੂੰ ਹੂੰ ਵਧੀਆ ਹੁਣ ਉਹਦੇ 'ਤੇ ਵੀ ਜਿਹੜੇ ਵਧੀਆ ਬਣਾਉਣੇ ਬਾਰੀਆਂ ਬੂਰੀਆਂ ਬਣਾਉਣੀਆਂ ਉਪਰ ਤੋਂ ਥੱਲੇ ਤੱਕ ਵਧੀਆ ਤਿਆਰ ਕਰਵਾਉਣਾ ਹਾਂ ਅਤੇ ਉਹਦੇ ਵਿੱਚ ਮਤਲਬ ਕਿ ਵੀ ਲੱਗ ਜਾਣਾ ਪੰਜਾਹ ਸੱਠ ਹਜ਼ਾਰ ਰੁਪਈਆ ਜੇ ਕੋਈ ਵਧੀਆ ਲੱਕੜ ਪਾ ਕੇ ਵਧੀਆ ਤਿਆਰ ਕਰਵਾਉਣੇ ਆ ਅੱਛਾ ਅੱਛਾ ਠੀਕ ਹੈ ਜੀ ਹਾਂਜੀ ਹਾਂਜੀ ਵਧੀਆ ਹੁੰਦਾ ਜੀ ਭਾਜੀ ਆਪਣਾ ਕਿਤੇ ਉਲਾਂਭਾ ਨਹੀਂ ਆਇਆ ਠੀ ਠੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਓਕੇ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ